ਪੁਰਾਣੇ ਸਮੇਂ ਵਿੱਚ ਲੋਕ ਕੱਪੜੇ ਹੱਥ ਨਾਲ ਧੋਂਦੇ ਸਨ ਜੋ ਕਿ ਬਹੁਤ ਹੀ ਮੁਸ਼ਕਲ ਹੁੰਦੇ ਸਨ ਕੱਪੜੇ ਧੋਣੇ ਵੀ ਬਹੁਤ ਮੁਸ਼ਕਲ ਹੁੰਦੇ ਸਨ ਅਤੇ ਨਿਚੋੜਨ ਵਿੱਚ ਵੀ ਬਹੁਤ ਮੁਸ਼ਕਲ ਆਉਂਦੀ ਸੀ ਪਰ ਅੱਜ ਇੱਕੀਵੀਂ ਸਦੀ ਵਿੱਚ ਬਹੁਤ ਸਾਰੀਆਂ ਮਸ਼ੀਨਸ ਆ ਗਈਆਂ ਹਨ ਜਿਸ ਨੂੰ ਅਸੀਂ ਬਹੁਤ ਆਸਾਨੀ ਨਾਲ ਕੱਪੜੇ ਧੋ ਸਕਦੇ ਹਾਂ ਜਿਵੇਂ ਕਿ ਅਸੀਂ ਮਸ਼ੀਨ ਵਿੱਚ ਪਾਣੀ ਪਾ ਕੇ ਥੋੜ੍ਹਾ ਸਰਫ਼ ਪਾ ਕੇ ਫਿਰ ਉਸਨੂੰ ਉਸ ਵਿੱਚ ਗੰਦੇ ਕੱਪੜੇ ਪਾ ਦਿੰਦੇ ਹਾਂ ਜਿਸ ਨੂੰ ਪੰਜ ਚਾਰ ਚਾਰ ਪੰਜ ਵਾਰ ਗੇੜਾ ਹੋਣ ਤੋਂ ਬਾਅਦ ਕੱਪੜੇ ਬਾਹਰ ਕੱਢ ਦਿੰਦੇ ਹਾਂ ਜਿਸ ਨਾਲ ਸਾਨੂੰ ਹੰਘਾਲਣ ਦੀ ਲੋੜ ਵੀ ਨਹੀਂ ਪੈਂਦੀ ਜੋ ਕਿ ਬਹੁਤ ਵਧੀਆ ਕੱਪੜੇ ਧੁਪ ਜਾਂਦੇ ਹਨ ਹੰਘਾਲਣ ਲਈ ਵੀ ਸਪਿਨ ਵਾਲੀ ਸਾਈਡ ਪਾਣੀ ਲਗਾ ਕੇ ਅਸੀਂ ਕੱਪੜੇ ਬੜੇ ਅਰਾਮ ਨਾਲ ਹੰਘਾਲ ਲੈਂਦੇ ਹਾਂ ਜਿਵੇਂ ਕਿ ਕੱਪੜੇ ਹੰਘਾਲਣ ਵਾਲੇ ਸਪਿਨ ਵਾਲੇ 'ਚ ਪਾ ਕੇ ਅਸੀਂ ਪਾਣੀ ਲਗਾ ਦਿੰਦੇ ਹਾਂ ਜੋ ਕਿ ਪਾਣੀ ਦਸ ਪੰਦਰਾਂ ਮਿੰਟ ਲਗਾਉਣ ਤੋਂ ਬਾਅਦ ਸਾਰਾ ਸਰਫ਼ ਨਿਕਲ ਜਾਂਦਾ ਹੈ ਅਤੇ ਜਿਸ ਨਾਲ ਅਰਾਮ ਨਾਲ ਕੱਪੜੇ ਧੁਪ ਜਾਂਦੇ ਹਨ ਅਤੇ ਪਾਣੀ ਨਿਕਲਣ ਤੋਂ ਬਾਅਦ ਪੰਜ ਦਸ ਮਿੰਟ ਅਸੀਂ ਕੱਪੜੇ ਸੁਕਾਉਣ ਵਾਲੇ ਬੰਨੇ ਪਾ ਦਿੰਦੇ ਹਾਂ ਜਿਸ ਨਾਲ ਕੱਪੜੇ ਅਰਾਮ ਨਾਲ ਸੁੱਕ ਜਾਂਦੇ ਹਨ ਅਤੇ ਇਸ ਨਾਲ ਸਾਨੂੰ ਹੱਥ ਨਾਲ ਨਿਚੋੜਨ ਦੀ ਵੀ ਕੋਈ ਲੋੜ ਨਹੀਂ ਪੈਂਦੀ ਅਤੇ ਕੱਪੜੇ ਆਰਾਮ ਨਾਲ ਸਪਿਨ ਹੋ ਜਾਂਦੇ ਹਨ ਫਿਰ ਅਸੀਂ ਉਸਨੂੰ ਕੱਢ ਕੇ ਧੁੱਪੇ ਜਾ ਕੇ ਸੁੱਕਣੇ ਪਾ ਦਿੰਦੇ ਹਾਂ ਜਿਸ ਨਾਲ ਸਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ